ਹਾਂ ਬਹੁਤ ਸਾਰੇ ਲੋਕ ਪਸ਼ੂਆਂ ਦਾ ਬੀਮਾ ਕਰਵਾਉਂਦੇ ਹਨ ਕਿਉਂਕਿ ਇਹ ਬਹੁਤ ਜ਼ਰੂਰੀ ਬਣ ਗਿਆ ਹੈ ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅੱਜ ਕੱਲ੍ਹ ਪਸ਼ੂਆਂ ਦੀ ਕੀਮਤ ਵਿੱਚ ਬਹੁਤ ਵਾਧਾ ਹੋ ਚੁੱਕਿਆ ਹੈ ਜਿਵੇਂ ਕਿ ਨੋਰਮਲੀ ਇੱਕ ਮੱਝ ਜਾਂ ਗਾਂ ਦੀ ਕੀਮਤ ਇੱਕ ਲੱਖ ਤੋਂ ਪਾਰ ਹੋ ਚੁੱਕੀ ਹੈ ਅਤੇ ਇਹ ਜੀਵਤ ਜਾ ਜਾਨਵਰ ਹੈ ਇਸਦੀ ਕਦੇ ਵੀ ਮੌਤ ਹੋ ਸਕਦੀ ਹੈ ਜਾਂ ਕਿਸੇ ਵੀ ਐਕਸੀਡੈਂਟ ਦੁਰਘਟਨਾ ਵਿੱਚ ਇਹ ਅਪਾਹਿਜ ਜਾਂ ਇਹਦੀ ਮੌਤ ਵੀ ਹੋ ਸਕਦੀ ਹੈ ਇਸ ਕਰਕੇ ਲੋਕ ਇਸਦਾ ਬੀਮਾ ਕਰਵਾਉਣਾ ਬਿਹਤਰ ਸਮਝਦੇ ਹਨ ਕਿਉਂਕਿ ਇਸਦੇ ਬੀਮਾ ਕਰਵਾਉਣ ਦੇ ਬਹੁਤ ਸਾਰੇ ਲਾਭ ਹਨ ਇਹ ਬੀਮਾ ਕਰਵਾਉਣ ਨਾਲ ਪਸ਼ੂ ਮਾ ਪਾਲਕ ਨੂੰ ਇਸਦੀ ਕੀਮਤ ਦਾ ਕੁਝ ਹਿੱਸਾ ਮਿਲ ਜਾਂਦਾ ਹੈ ਅਤੇ ਉਸਨੂੰ ਬਹੁਤ ਸਾਰਾ ਨੁਕਸਾਨ ਨਹੀਂ ਝੱਲਣਾ ਪੈਂਦਾ ਅਤੇ ਉਹ ਆਪਣਾ ਕਾਰੋਬਾਰ ਜਾਂ ਦੁਬਾਰਾ ਪਸ਼ੂ ਖਰੀਦ ਸਕਦਾ ਹੁੰਦਾ ਹੈ ਪਸ਼ੂ ਦਾ ਬੀਮਾ ਕਰਵਾਉਣ ਲਈ ਸਰਕਾਰੀ ਹਸਪਤਾਲ ਤੋਂ ਕੁਝ ਪੇਪਰ ਤਿਆਰ ਕਰਵਾ ਕੇ ਸਰਕਾਰੀ ਬੈਂਕ ਦੁਆਰਾ ਕਰਵਾਇਆ ਜਾ ਸਕਦਾ ਹੈ ਇਹ ਪਸ਼ੂ ਪ ਪਸ਼ੂਆਂ ਦਾ ਬੀਮਾ ਕਿਸੇ ਪ੍ਰਾਈਵੇਟ ਫਰਮ ਦੁਆਰਾ ਵੀ ਕੀਤਾ ਜਾਂਦਾ ਹੈ ਅਜਿਹੇ ਕੁਝ ਲੋੜੀਂਦੇ ਦਸਤਾਵੇਜ਼ ਜ਼ਰੂਰੀ ਹੁੰਦੇ ਹਨ ਜਿਵੇਂ ਪਸੂ ਪਾਲਕਾਂ ਦੇ ਕੁਝ ਅਡੈਂਟੀ ਕਾਰਡ ਦੀ ਵੀ ਲੋੜ ਪੈਂਦੀ ਹੈ ਕਿਸੇ ਵੀ ਸਰਕਾਰੀ ਸੰਸਥਾ ਦੁਆਰਾ ਇਸ ਦਾ ਰੇਟ ਫਿਕਸ ਕੀਤਾ ਜਾਂਦਾ ਹੈ ਅਤੇ ਉਸ ਦੀ ਕੀਮਤ ਦਾ ਕੁਝ ਹਿੱਸਾ ਜੋ ਕਿ ਪ੍ਰਾਈਵੇਟ ਫਰਮ ਦੁਆਰਾ ਪਸ਼ੂ ਦੀ ਮੌਤ ਹੋ ਜਾਣ 'ਤੇ ਦਿੱਤਾ ਜਾਂਦਾ ਹੈ ਉਸਦਾ ਅਨੁਮਾਨ ਲਗਾਇਆ ਜਾਂਦਾ ਹੈ